ਜੇਕਰ ਖਾਣਾ ਬਣਾਉਣ ਦੇ ਵਿੱਚ ਲੱਗਣ ਵਾਲਾ ਸਮਾਂ ਜਾਂ ਉਸ 'ਤੇ ਬਿਤਾਉਣ ਵਾਲੇ ਸਮੇਂ ਦੀ ਅਸੀਂ ਗੱਲ ਕਰੀਏ ਤਾਂ ਅਕਸਰ ਮੈਂ ਜਿਹੜਾ ਹੈ ਮੈਨੂੰ ਲੱਗਦਾ ਵੀ ਇੱਕ ਤੋਂ ਦੋ ਘੰਟੇ ਉਸਦੇ ਵਿੱਚ ਜਾਇਜ਼ ਹੁੰਦੇ ਨੇ ਕਿ ਇੰਨਾ ਕੁ ਟਾਈਮ ਸਾਨੂੰ ਖਾਣਾ ਬਣਾਉਣ ਵਾਸਤੇ ਲੱਗ ਜਾਂਦਾ ਜੇ ਆਪਾਂ ਰੋਟੀ ਸਬਜ਼ੀ ਕੱਟਣ ਵੱਢਣ ਤੋਂ ਲੈ ਕੇ ਪੂਰੀ ਬਣਾਉਣ ਤੱਕ ਦੀ ਗੱਲ ਕਰੀਏ ਅਤੇ ਉਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਸਨੈਕਸ ਵਗੈਰਾ ਦੀ ਉਹਨਾਂ ਨੂੰ ਵੱਧ ਤੋਂ ਵੱਧ ਪੰਦਰਾਂ ਵੀਹ ਮਿੰਟ ਜਾਂ ਅੱਧਾ ਘੰਟਾ ਲੱਗ ਜਾਂਦਾ ਅਤੇ ਉਹ ਵੀ ਡਿਪੈਂਡ ਕਰਦਾ ਵੀ ਤੁਸੀਂ ਜ਼ਿਆਦਾਤਰ ਰੇਡੀ ਚ ਰੇਡੀਮੇਟ ਚੀਜ਼ਾਂ ਨਾਲ਼ ਸਨੈਕਸ ਬਣਾ ਰਹੇ ਹੋ ਕਿ ਤੁਸੀਂ ਫਰੋਮ ਸਕਰੈਚ ਯਾਨੀ ਕਿ ਸ਼ੁਰੂ ਤੋਂ ਸਾਰਾ ਕੁਛ ਰੋਅ ਮਟੀਰੀਅਲ ਲੈ ਕੇ ਸਨੈਕਸ ਬਣਾ ਰਹੇ ਹੋ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਗੁੰਝਲਦਾਰ ਰੈਸਿਪੀ ਦੀ ਜਿਸਦੀ ਜਿਸਦੀ ਨੌਲੇਜ ਮੈਨੂੰ ਚੰਗੇ ਤਰੀਕੇ ਨਾਲ਼ ਨਹੀਂ ਸੀ ਪਰ ਮੈਂ ਫਿਰ ਵੀ ਟ੍ਰਾਈ ਕੀਤੀ ਉਹ ਸੀਗੀ ਮਸਾਲਾ ਇਡਲੀ ਤਾਂ ਹੁਣੇ ਹੀ ਥੋੜ੍ਹੇ ਦਿਨ ਪਹਿਲੇ ਮੈਂ ਯੂਟੀਊਬ 'ਤੇ ਇੱਕ ਵੀਡੀਓ ਦੇਖੀ ਜਿਸ ਦੇ ਵਿੱਚ ਲਿਖਿਆ ਸੀ ਪੰਦਰਾਂ ਮਿੰਟ ਦੇ ਵਿੱਚ ਬਣਾਉ ਸਵਾਦਿਸ਼ਟ ਨਾਸ਼ਤਾ ਅਤੇ ਜਦ ਮੈਂ ਦੇਖਿਆ ਕਿ ਇਹ ਰੈਸਿਪੀ ਖਾਣ ਵਿੱਚ ਅਤੇ ਦੇਖਣ ਵਿੱਚ ਬਹੁਤ ਸਵਾਦ ਲੱਗ ਰਹੀ ਹੈ ਤਾਂ ਮੈਂ ਟ੍ਰਾਈ ਕੀਤਾ ਮੇਰੇ ਕੋਲ ਖੱਟਾ ਦਹੀਂ ਅਤੇ ਸੂਜੀ ਪਈ ਸੀ ਘਰ ਦੇ ਅੰਦਰ ਅਤੇ ਰੈਸਿਪੀ ਦੇ ਵਿੱਚ ਉਹਦਾ ਹੀ ਜ਼ਿਆਦਾਤਰ ਸੇਵਨ ਹੋਣਾ ਸੀ ਅਤੇ ਮੈਂ ਮਸਾਲਾ ਇਡਲੀ ਬਣਾਉਣ ਲਈ ਤਿਆਰੀ ਸ਼ੁਰੂ ਕੀਤੀ ਪਹਿਲਾਂ ਅੱਧਾ ਘੰਟਾ ਮੈਨੂੰ ਬੈਟਰ ਨੂੰ ਰੱਖਣਾ ਪਿਆ ਤਾਂ ਕਿ ਬੈਟਰ ਜਿਹੜਾ ਥੋੜ੍ਹਾ ਜਿਹਾ ਫੁੰਡ ਜਾਵੇ ਅਤੇ ਉਸ ਤੋਂ ਬਾਅਦ ਜਿਹੜਾ ਇਡਲੀ ਬਣਾਉਣ ਦਾ ਪ੍ਰੋਸੈੱਸ ਸ਼ੁਰੂ ਹੋਣਾ ਸੀ ਉਸ ਤੋਂ ਬਾਅਦ ਮੈਂ ਗਰਮ ਪਾਣੀ ਦਾ ਕੁੱਕਰ ਚੜ੍ਹਾਇਆ ਅਤੇ ਇਡਲੀ ਦੇ ਸਾਂਚਿਆਂ ਵਿੱਚ ਇਡਲੀ ਦਾ ਬੈਟਰ ਭਰ ਕੇ ਉਸਨੂੰ ਘੱਟੋ ਘੱਟ ਪੰਦਰਾਂ ਵੀਹ ਮਿੰਟ ਲਈ ਪਕਾਉਣ ਲਈ ਰੱਖਤਾ ਜਿਸ ਤਰੀਕੇ ਨਾਲ਼ ਰੈਸਿਪੀ 'ਚ ਦੱਸਿਆ ਗਿਆ ਸੀ ਪਰ ਜਦ ਮੈਂ ਇਡਲੀਆਂ ਬਾਹਰ ਕੱਢੀਆਂ ਤਾਂ ਦੇਖੀਆਂ ਵੀ ਉਹ ਫਲੱਫੀ ਨਹੀਂ ਸੀਗੀਆਂ ਜਿਸ ਤਰੀਕੇ ਨਾਲ਼ ਉਹ ਵੀਡੀਓ 'ਚ ਦਿਖਾਈਆਂ ਜਾ ਰਹੀਆਂ ਸੀ ਫਿਰ ਉਸ ਤੋਂ ਬਾਅਦ ਮੈਂ ਫਿਰ ਆਪਣੇ ਬੈਟਰ ਦੀ ਜਿਹੜੀ ਕੰਜਸਸ ਕੰਸਿਸਟੈਂਸੀ ਹੈ ਉਹਨੂੰ ਮੈਂ ਚੈੱਕ ਕੀਤਾ ਅਤੇ ਦੁਬਾਰਾ ਇਡਲੀਆਂ ਰੱਖੀਆਂ ਵਿੱਚ ਸਾਂਚੇ ਦੇ ਅਤੇ ਫਿਰ ਉਹਨਾਂ ਨੂੰ ਦਸ ਪੰਦਰਾਂ ਮਿੰਟ ਲਈ ਛੱਡਿਆ ਅਤੇ ਜਿੱਦਾਂ ਜਿੱਦਾਂ ਫਿਰ ਮੈਂ ਦੋ ਤਿੰਨ ਵਾਰ ਇਡਲੀਆਂ ਬਣਾਈਆਂ ਤਾਂ ਮੈਨੂੰ ਜਾ ਕੇ ਤੀਜੇ ਚੌਥੇ ਅਟੈਮਟ ਦ ਅਟੈਮਟ ਦੇ ਵਿੱਚ ਪਤਾ ਲੱਗਿਆ ਕਿ ਜਿਹੜਾ ਬੈਟਰ ਹੈ ਉਹਦੀ ਕੰਸਿਸਟੈਂਸੀ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਅਤੇ ਉਹਨਾਂ ਨੇ ਜਿਹੜਾ ਵੀਡੀਓ ਸੀ ਉਹਦੇ ਵਿੱਚ ਇਨੋ ਦਾ ਸੇਵਨ ਨਹੀਂ ਕੀਤਾ ਹੋਇਆ ਸੀ ਪਰ ਮੈਨੂੰ ਲੱਗਿਆ ਵੀ ਕੇਕਸ ਜਾਂ ਕੋਈ ਵੀ ਫਲੱਫੀ ਚੀਜ਼ ਬਣਾਉਣੀ ਹੁੰਦੀ ਹੈ ਤਾਂ ਜੇ ਅਸੀਂ ਉਹਦੇ ਵਿੱਚ ਇਨੋ ਪਾ ਦੇਈਏ ਤਾਂ ਉਹ ਵਧੀਆ ਬਣ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਜੇ ਮੈਂ ਇਨੋ ਯੂਜ ਕਰਾਂਗੀ ਤਾਂ ਉਹ ਵਧੀਆ ਬਣੂੰਗੀ ਅਤੇ ਕਰਦੇ ਕਰਦੇ ਮੈਂ ਸੋਚਿਆ ਨਹੀਂ ਸੀ ਪਰ ਮੈਨੂੰ ਘੱਟੋ ਘੱਟ ਚਾਰ ਤੋਂ ਪੰਜ ਘੰਟੇ ਇਸ ਪ੍ਰੋਸੈਸ ਦੇ ਵਿੱਚ ਲੱਗ ਗਏ ਕਿਉਂਕਿ ਇਡਲੀਆਂ ਬਣਨ ਤੋਂ ਬਾਅਦ ਉਹ ਸਬਜ਼ੀਆਂ ਕੱਟ ਕੇ ਫਰਾਈ ਪਿੰਨ ਦੇ ਵਿੱਚ ਉਹਨਾਂ ਨੂੰ ਤੜਕਾ ਵੀ ਲਾਉਣਾ ਸੀ ਤਾਂ ਜਾ ਕੇ ਸਾਡਾ ਜਿਹੜਾ ਮਸਾਲਾ ਇਡਲੀ ਹੈ ਉਹ ਤਿਆਰ ਹੋਣੀ ਸੀ ਅਤੇ ਰੈਸਿਪੀ ਬਹੁਤ ਗੁੰਝਲਦਾਰ ਰਹੀ ਪਰ ਮਜ਼ਾ ਆਇਆ ਮੈਨੂੰ ਮੈਂ ਬਹੁਤ ਕੁਝ ਸਿੱਖਿਆ ਹੁਣ ਮੈਨੂੰ ਇਡਲੀਆਂ ਬਣਾਉਣ ਵਿੱਚ ਚਾਰ ਪੰਜ ਘੰਟੇ ਤਾਂ ਨਹੀਂ ਲੱਗਦੇ ਪਰ ਘੱਟੋ ਘੱਟ ਡੇਢ ਤੋਂ ਦੋ ਜਾਂ ਕਹਿ ਲਉ ਢਾਈ ਘੰਟੇ ਤਾਂ ਲੱਗ ਹੀ ਜਾਂਦੇ ਨੇ